ਜਿਹੜੀ ਘਰ ਦੀ ਬਗੀਚੀ ਹੈਗੀ ਹੈ ਇਹ ਸਸਤੇ ਦੇ ਨਾਲ਼ ਨਾਲ਼ ਮਹਿੰਗੀ ਵੀ ਪੈਂਦੀ ਹੈਗੀ ਹੈ ਕਿਉਂਕੀ ਜਿੱਦਾਂ ਹੁਣ ਆਪਾਂ ਦੇਖਿਆ ਜਾਵੇ ਜਿਹੜੇ ਬਗੀਚੀ ਵਾਸਤੇ ਸਭ ਤੋਂ ਜਿਹੜੀ ਮੇਨ ਚੀਜ਼ ਹੁੰਦੀ ਹੈਗੀ ਬੇਸ ਚੀਜ਼ ਹੁੰਦੀ ਹੈਗੀ ਹੈ ਉਹ ਹੁੰਦੀ ਹੈ ਉਹਦਾ ਬੀਜ ਕਿਉਂਕੀ ਇਹਦਾ ਬੀਜ ਵੀ ਫਿਰ ਵੀ ਬੀਜ ਵੀ ਮਤਲਬ ਠੀਕ ਠਾਕ ਰੇਟ 'ਤੇ ਮਿਲ ਜਾਂਦਾ ਹੈਗਾ ਏ ਮਤਲਬ ਥੋੜ੍ਹਾ ਉਹ ਵੀ ਮਹਿੰਗਾ ਹੁੰਦਾ ਹੈਗਾ ਏ ਇਹਦੇ ਨਾਲ਼ ਨਾਲ਼ ਜਿੱਦਾਂ ਹੁਣ ਆਪਾਂ ਦੇਖਿਆ ਜਾਵੇ ਇਹਦੇ ਵਾਸਤੇ ਇੱਕ ਤਾਂ ਹੁੰਦੇ ਹੈਗੇ ਬੰਦੇ ਨੇ ਜਿੱਦਾਂ ਹੁਣ ਖੇਤੀ ਜਿਹੜੀ ਹੈਗੀ ਹੈ ਬਗੀਚੀ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਆ ਇੱਕ ਤਾਂ ਹੁੰਦੀ ਖੋ ਕੁਦਰਤੀ ਖਾਦ ਜਿੱਦਾਂ ਹੁਣ ਔਰਗੈਨਿਕ ਖਾਦ ਕਿਸ ਨੇ ਪਾਉਣੀ ਹੋਵੇ ਹੈ ਉਹਦੇ ਨਾਲ ਜਿਹੜੀ ਬਗੀਚੀ ਹੈਗੀ ਹੈ ਉਹ ਬੜੀ ਵਧੀਆ ਫੁ ਫਲ਼ਦੀ ਫੁੱਲਦੀ ਹੈਗੀ ਹੈ ਮਤਲਬ ਬੜੀ ਵਧੀਆ ਰਹਿੰਦੀ ਹੈਗੀ ਆ ਉਹਦੀ ਗਰੋਥ ਵੀ ਅੱਛੀ ਹੋ ਜਾਂਦੀ ਹੈਗੀ ਆ ਉਹਦੀ ਉਹ ਤੋਂ ਇਲਾਵਾ ਜਿੱਦਾਂ ਆਪਾਂ ਦੇਖਿਆ ਜਾਵੇ ਜਿਹੜਾ ਜਿੰਨਾ ਦੂਜੀ ਤਰ੍ਹਾਂ ਨਾਲ਼ ਦੂਜਾ ਢੰਗ ਨਾਲ ਕਰਨੀ ਆ ਮਤਲਬ ਜਿਹਨੇ ਕੀਟਨਾਸ਼ਕ ਖਾਦਾਂ ਜਾਂ ਜਿਹੜੇ ਕੀੜੇ ਮਾਰ ਦਵਾਈਆਂ ਨਾਲ਼ ਜਿਹਨੇ ਇਹ ਖੇਤੀ ਕਰਨੀ ਹੁੰਦੀ ਹੈਗੀ ਹੈ ਉਹਨੂੰ ਇਹ ਕਾਫੀ ਮਹਿੰਗੀ ਪੈਂਦੀ ਹੈਗੀ ਆ ਉਹ ਮਹਿੰਗੀ ਕਿੱਦਾਂ ਪੈਂਦੀ ਹੈ ਕਿਉਂਕਿ ਇਹਨਾਂ ਨੂੰ ਜੇ ਅਗਰ ਕਿਉਂਕਿ ਜਿੱਦਾਂ ਹੁਣ ਆਪਾਂ ਕੀਟਨਾਸ਼ਕ ਖਾਦਾਂ ਛੜਕਾਉਂਦੇ ਹੈਗੇ ਹੈ ਉਹਦਾ ਜੇ ਇੱਕ ਫਾਇਦਾ ਤਾਂ ਦੂਜਾ ਨੁਕਸਾਨ ਵੀ ਹੁੰਦਾ ਉਹਦਾ ਦੂਜਾ ਫੇਸ ਵੀ ਹੁੰਦਾ ਹੈਗਾ ਏ ਉਹ ਇਸ ਤਰ੍ਹਾਂ ਦੇਖਿਆ ਜਾਵੇ ਜਿਹੜੀ ਹੁੰਦੀ ਹੈਗੀ ਹੈ ਜਿਹੜੀ ਬਗੀਚੀ ਹੈਗੀ ਆ ਜਿੱਦਾ ਕੀਟਾਸ਼ਨਕ ਖਾਦਾਂ ਨੇ ਕੀ ਕੀਟਨਾਸ਼ਕ ਖਾਦਾਂ ਛੜਕਾਅ ਕੇ ਕੀਤੀ ਜਾਂਦੀ ਆ ਉਹ ਮਹਿੰਗੀ ਪੈਂਦੀ ਹੈਗੀ ਹੈ ਕਿਉਂਕਿ ਉਹਦੇ ਵਿੱਚ ਕਦੇ ਕੁਝ ਹੋ ਗਿਆ ਫੁੱਲਾਂ ਨੂੰ ਕਦੇ ਕੁਝ ਹੋ ਗਿਆ ਬਗੀਚੇ ਵਿੱਚ ਉਹਦੇ ਵਾਸਤੇ ਸਾਨੂੰ ਅਲੱਗ ਅਲੱਗ ਤਰ੍ਹਾਂ ਦੇ ਸਪਰੇਅ ਵਗੈਰਾ ਜਾਂ ਹੋਰ ਵੀ ਕੀੜੇ ਮਾਰ ਦਵਾਈਆਂ ਸਾਨੂੰ ਛੜਕਾਅ ਛੜਕਾਅ ਕਰਨਾ ਪੈਂਦਾ ਰਹਿੰਦਾ ਹੈਗਾ ਏ